ਪੰਜਾਬ ਦੀ ਸੁਹਸੀ ਪ੍ਰਕਿਰਿਆ ਅਤੇ ਸਿਵਰ ਸਾਇਟੀ ਅਤੇ ਗੈਰ ਸੰਸਥਾਵਾਂ ਦੀ ਭੂਮੀਕਾ ਜਿਵੇਂ ਕਿ ਸਿਵਿਲ ਸੁਸਾਇਟੀ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੇ ਕਿ ਸਰਕਾਰੀ ਕੰਮ ਅਸੀਂ ਸਰਕਾਰ ਦੁਆਰਾ ਕੀਤੇ ਜਾਂਦੇ ਹਨ ਜੋ ਕਿ ਅਸੀਂ ਆਪਣੀ ਕਿਉਂਕਿ ਅਸੀਂ ਆਪਣੇ ਧਰਨੇ ਵਗੈਰਾ ਲਈ ਕਰ ਸਕਦੇ ਹਾਂ ਅਤੇ ਅਤੇ ਗੈਰ ਸਰਕਾਰੀ ਸੰਸਥਾਵਾਂ ਉਹ ਹੁੰਦੀਆਂ ਹਨ ਜੋ ਕਿ ਪ੍ਰਾਈਵੇਟ ਹੁੰਦੇ ਹਨ ਪ੍ਰਾਈਵੇਟ ਪ੍ਰਾਈਵੇਟ ਥਾਵਾਂ ਵਿੱਚ ਪੈਸੇ ਚੱਲਦਾ ਹੈ ਕਿ ਜੋ ਕਿ ਸਰਕਾਰੀ ਸੰਸਥਾਵਾਂ ਵਿੱਚ ਪੈਸਾ ਨਹੀਂ ਚੱਲਦਾ ਜੋ ਕਿ ਕਾ ਸਰਕਾਰੀ ਕੰਮ ਕੀਤੇ ਜਾਂਦੇ ਹਨ ਅਤੇ ਗੈਰ ਸ ਗੈਰ ਸਰਕਾਰੀ ਵਿੱਚ ਪ੍ਰਾਈਵੇਟ ਕੰਮ ਕੀਤੇ ਹਨ ਗੈਰ ਪ੍ਰਾਈਵੇਟ ਸ ਗੈਸ ਸਰਕਾਰੀ ਵਿੱਚ ਹਮੇਸ਼ਾ ਪੈਸੇ ਜ਼ਿਆਦਾ ਜਾਂਦਾ ਪੈਸੇ ਨਾਲ ਕੰਮ ਕੀਤਾ ਜਾਂਦਾ ਹੈ ਅਤੇ ਸਿਵਰ ਸੋਸਾਇਟੀ ਵਿੱਚ ਸਰਕਾਰ ਦੁਆਰਾ ਸਰਵਕਾਰ ਦੁਆਰਾ ਕੀਤੇ ਗਏ ਨਿਯਮਾਂ ਦੀ ਪਾ ਨਿਯਮਾਂ ਨੂੰ ਲਾਗੂ ਕਰਨ ਦਾ ਪੈਂਦਾ ਹੈ ਜਿਵੇਂ ਕਿ ਪੈਸਾ 'ਤੇ ਪਾਬੰਦੀ ਕਰਨੀ ਅਤੇ ਉਹਨਾਂ ਦੇ ਨਿਯਮਾਂ ਨੂੰ ਲਾਗੂ ਕਰਨਾ ਅਸੀਂ ਉਹਨਾਂ ਦੇ ਨਿਯਮਾਂ ਕਿਵੇਂ ਦੀ ਲਾਗੂ ਕਰ ਸਕਦੇ ਹਾਂ ਅਤੇ ਉਹਨਾਂ ਦੇ ਨਿਯਮਾਂ ਨੂੰ ਅਸੀਂ ਅਪਣਾ ਸਕੀਏ ਅਤੇ ਗੈਰ ਸ ਗੈਰ ਸਰਕਾਰੀ ਕੰਮ ਉਹ ਹੁੰਦੇ ਹਨ ਜੋ ਕਿ ਪ੍ਰਾਈਵੇਟ ਹੁੰਦੇ ਪ੍ਰਾਈ ਪ੍ਰਾਈਵੇਟ ਕੰਮਾਂ ਵਿੱਚ ਅਸੀਂ ਕੋਈ ਵੀ ਉਹਨਾਂ ਦੀ ਕੰਮ ਨਹੀਂ ਕਰਦਾ ਅਤੇ ਜੋ ਕਿ ਉਹਨਾਂ ਦੇ ਗੱਲ ਨਹੀਂ ਮੰਨੀ ਜਾਂਦੀ ਅਤੇ ਸਰਕਾਰੀ ਕੰਮ ਵਿੱਚ ਅਸੀਂ ਆਪਣੇ ਕੋਈ ਵੀ ਮੁਸ਼ਕਿਲ ਨੂੰ ਹੱਲ ਕਰਨ ਲਈ ਤਾਂ ਜੋ ਕਿ ਧਰਨੇ ਲਗਾਏ ਜਾਂਦੇ ਹਨ ਤਾਂ ਕਿਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਧਰਨੇ ਨਹੀਂ ਲਗਾਏ ਜਾਂਦੇ ਅਤੇ ਸਰਕਾਰੀ ਧਰਨੇ ਇਸ ਲਈ ਲਗਾਏ ਹਨ ਤਾਂ ਜੋ ਕਿ ਸਰਕਾਰ ਦੁਆਰਾ ਸਾਡੇ ਕੰਮ ਹੋ ਸਕਣ ਅਤੇ ਅਸੀਂ ਉਹਨਾਂ ਦੀ ਫਿਰ ਅਸੀਂ ਉਹਨਾਂ ਨਿਯਮਾਂ ਨੂੰ ਲਾਗੂ ਕਰ ਸਕਦੇ ਹਾਂ